ਪੰਜਾਬ 'ਚ ਕਾਰੋਬਾਰ ਲਈ ਫੰਡਿੰਗ ਦੇ ਸਰੋਤ ਤਾਂ ਮੇਰੇ ਖਿਆਲ 'ਚ ਬੈਂਕ ਹੀ ਨੇ ਜਿੱਥੋਂ ਸਾਨੂੰ ਬਹੁਤ ਸਾਰੇ ਲੋਨ ਮਿਲ ਸਕਦੇ ਨੇ ਅਤੇ ਇਸ ਤੋਂ ਇਲਾਵਾ ਨਿਵੇਸ਼ ਤੁਸੀਂ ਜੇ ਕਰਨਾ ਤਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਫੈਕਟਰੀਜ ਨੇ ਸ਼ੇਅਰ ਮਾਰਕੀਟ ਹੈ ਜਿੱਥੇ ਤੁਸੀਂ ਆਪਣਾ ਨਿਵੇਸ਼ ਕਰ ਸਕਦੇ ਹੋ ਬਹੁਤ ਸਾਰੇ ਉਦਯੋਗ ਨੇ ਜਿਨ੍ਹਾਂ 'ਚ ਤੁਸੀਂ ਆਪਦਾ ਕੁਝ ਪਰਸੈਂਟ ਹਿੱਸਾ ਪਾ ਸਕਦੇ ਹੋ ਵੈਸੇ ਮੇਰਾ ਸੰਬੰਧ ਇੱਕ ਛੋਟੇ ਜਿਹੇ ਉਦਯੋਗ ਨਾਲ ਹੈ ਜਿਵੇਂ ਮੈਨੂੰ ਕੱਪੜੇ ਦਾ ਵਪਾਰ ਬਹੁਤ ਵਧੀਆ ਲੱਗਦਾ ਪਿਛਲੇ ਕਈ ਦਿਨਾਂ ਤੋਂ ਮੈਂ ਉਹਨੂੰ ਬਹੁਤ ਚੰਗੀ ਤਰ੍ਹਾਂ ਵਾਚਿਆ ਵੇਖਿਆ ਤਾਂ ਉਹਦੇ ਲਈ ਜਿਹੜਾ ਫੰਡਿੰਗ ਹੈ ਕੋਈ ਬਹੁਤ ਜ਼ਰੂਰਤ ਬਹੁਤ ਬਹੁਤ ਫੰਡਿੰਗ ਦੀ ਲੋੜ ਨਹੀਂ ਹੁੰਦੀ ਅਤੇ ਤੁਸੀਂ ਸੁਖਾਲਾ ਹੀ ਉਸਨੂੰ ਕਰ ਸਕਦੇ ਹੋ ਅਤੇ ਅੱਜ ਕੱਲ੍ਹ ਚਰਚਿਤ ਵੀ ਹੈ ਪ੍ਰਚੱਲਿਤ ਵੀ ਹੈ ਕਿਉਂਕਿ ਕੱਪੜਾ ਹਮੇਸ਼ਾ ਹੀ ਮਨੁੱਖ ਦੀ ਲੋੜ 'ਚ ਰਹਿਣਾ ਹੈ ਅਤੇ ਹਮੇਸ਼ਾ ਹੀ ਚੱਲਦਾ ਹੀ ਰਹਿਣਾ ਇਸ ਤੋਂ ਇਲਾਵਾ ਗੱਲ ਹੈ ਕਿ ਜੇ ਤੁਸੀਂ ਵੱਡੇ ਪੱਧਰ 'ਤੇ ਕੋਈ ਕਾਰੋਬਾਰ ਕਰਨਾ ਹੈ ਤਾਂ ਉਸ ਲਈ ਵੱਖਰੀਆਂ ਵੱਖਰੀਆਂ ਫਾਈਨੈਂਸ ਕੰਪਨੀਆਂ ਵੀ ਬਣੀਆਂ ਹੋਈਆਂ ਨੇ ਜਿੱਥੇ ਤੁਹਾਨੂੰ ਲੋਨ ਆਦਿ ਦਾ ਜਿਹੜਾ ਹੈ ਰੱਖ ਰਖਾਵ ਦਾ ਵੀ ਤੁਹਾਨੂੰ ਮਿਲਦਾ ਹੈ ਸਹੂਲਤ ਮਿਲਦੀ ਹੈ ਉਹਦੇ ਵੱਖਰੇ ਵੱਖਰੇ ਜੋ ਜਿਹੜੀਆਂ ਵੀ ਟਰਮਸ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀਆਂ ਜੋ ਸਾਨੂੰ ਪੂਰੀਆਂ ਕਰਨੀਆਂ ਪੈਂਦੀਆਂ ਜੋ ਸ਼ਰਤਾਂ ਨੇ ਜੋ ਨਿਯਮ ਨੇ ਉਸ ਆਧਾਰ 'ਤੇ ਅਸੀਂ ਪੰਜਾਬ ਦੇ ਕਾਰੋਬਾਰ ਨੂੰ ਅੱਗੇ ਲਿਜਾ ਸਕਦੇ ਹਾਂ